ਮੈਂ ਰਜੇਸ਼ ਕੁਮਾਰ ਵਾਸੀ ਫਿਰੋਜ਼ਪੁਰ ਕਲਾਂ ਸੁਜਾਨਪੁਰ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਪਿਛਲੇ ਹਫ਼ਤੇ ਕਿਸੇ ਸਾਥੀ ਨਾਲ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ ਅਤੇ ਅਸੀਂ ਦਿੱਲੀ ਵੱਲ ਨੂੰ ਜਾ ਨਿਕਲੇ ਦਿੱਲੀ ਵਿੱਚ ਅਸੀਂ ਦੋ ਚਾਰ ਦਿਨ ਘੁੰਮੇ ਅਤੇ ਫਿਰ ਅਸੀਂ ਜਦੋਂ ਵਾਪਸ ਪਰਤਣਾ ਸੀ ਤਾਂ ਅਸੀਂ ਉਥੋਂ ਇੱਕ ਸ਼ਿਵਾ ਟਰੈਵਲ ਏਜੰਸੀ ਤੋਂ ਇੱਕ ਕੈਬ ਮੰਗਵਾਈ ਜਿਹੜੀ ਕਿ ਸਾਡੇ ਕੋਲ ਆ ਗਈ ਅਤੇ ਜਦੋਂ ਅਸੀਂ ਉਸ ਕੈਬ ਵਿੱਚ ਬੈਠੇ ਤਾਂ ਅਸੀਂ ਪਾਣੀਪਤ ਕਰਨਾਲ ਆਦਿ ਥਾਵਾਂ ਤੋਂ ਹੁੰਦੇ ਹੋਏ ਅੰਬਾਲਾ ਸ਼ਹਿਰ ਲੁਧਿਆਣਾ ਸ਼ਹਿਰ ਵਿੱਚ ਪਹੁੰਚੇ ਅਤੇ ਰਸਤੇ ਵਿੱਚ ਕਿਸਾਨਾਂ ਨੇ ਬੜਾ ਭਾਰੀ ਜਾਮ ਲਗਾਇਆ ਹੋਇਆ ਸੀ ਜੋ ਕਿ ਕਿਸੇ ਵੀ ਸਾਥੀ ਨੂੰ ਲੰਘਣ ਨਹੀਂ ਸੀ ਦੇ ਰਹੇ ਪਰ ਸਾਡੇ ਕੈਬ ਡਰਾਈਵਰ ਅਸ਼ੋਕ ਕੁਮਾਰ ਜੀ ਨੇ ਬੜੀ ਹੀ ਵਧੀਆ ਤਰੀਕੇ ਦੇ ਨਾਲ ਵਧੀਆ ਆਪਣੀ ਸੇਫਟੀ ਦੇ ਨਾਲ ਪਿੰਡਾਂ ਪਿੰਡਾਂ ਦੇ ਵਿੱਚੋਂ ਆਪਣੀ ਗੱਡੀ ਨੂੰ ਕੱਢ ਕੇ ਉਹ ਜਲੰਧਰ ਵੱਲ ਆ ਨਿਕਲੇ ਮੈਨੂੰ ਉਸ ਡਰਾਈਵਰ 'ਤੇ ਬੜੀ ਹੈਰਾਨੀ ਹੋਈ ਕਿ ਉਸ ਨੇ ਬੜੀ ਵਧੀਆ ਤਰੀਕੇ ਨਾਲ ਸਾਨੂੰ ਤਿੰਨ ਸੱਜਣਾਂ ਨੂੰ ਜੋ ਕਿ ਅਸੀਂ ਉਹਨਾਂ ਦੀ ਕੈਬ ਵਿਚ ਸਵਾਰ ਸਾਂ ਸਾਨੂੰ ਸਹੀ ਸਥਾਨ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਰਸਤੇ ਵਿੱਚ ਅਸੀਂ ਰੁਕੇ ਪਹਿਲਾਂ ਅਸੀਂ ਚਾਹ ਪਾਣੀ ਪੀਤਾ ਫਿਰ ਅਸੀਂ ਅੱਗੇ ਆ ਗਏ ਲੰਗਰ ਛਕਿਆ ਅਤੇ ਅਸੀਂ ਅੱਗੇ ਨੂੰ ਵੱਧਦੇ ਹੋਏ ਆਪਣੇ ਇਲਾਕੇ ਵਿੱਚ ਆ ਪਹੁੰਚੇ ਫਿਰ ਉਹਨਾਂ ਨੇ ਸਾਨੂੰ ਰਸਤੇ ਵਿੱਚ ਇੰਨੀਆਂ ਕਹਾਣੀਆਂ ਸੁਣਾਈਆਂ ਇੰਨੇ ਵਾਰਤਾਲਾਪ ਸੁਣਾਏ ਜੋ ਕਿ ਅਸੀਂ ਵੀ ਉਹਨਾਂ ਨੂੰ ਥਾਂ ਥਾਂ ਟੋਟਕੇ ਜੋੜ ਕੇ ਜੋੜੇ ਹੋਏ ਕਵਿਤਾ ਦੇ ਕਵਿਤਾ ਦੀਆਂ ਲਾਈਨਾਂ ਜਾਂ ਕਹਾਣੀਆਂ ਦੀਆਂ ਸਤਰਾਂ ਉਹਨਾਂ ਨੂੰ ਸੁਣਾਈਆਂ ਜੋ ਕਿ ਉਹ ਸਾਨੂੰ ਸਾਡੇ ਕੋਲੋਂ ਸੁਣ ਕੇ ਬੜੇ ਪ੍ਰਭਾਵਿਤ ਹੋਏ ਮੈਂ ਉਸ ਡਰਾਈਵਰ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਅਤੇ ਖ਼ਾਸ ਕਰ ਕੇ ਸ਼ਿਵਾ ਟਰੈਵਲ ਏਜੰਸੀ ਜਿਨ੍ਹਾਂ ਤੋਂ ਮੈਂ ਉਹ ਗੱਡੀ ਮੰਗਵਾਈ ਸੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਲਿਆ ਕੇ ਸਾਡੇ ਸ਼ਹਿਰ ਪਠਾਨਕੋਟ ਵਿੱਚ ਪਹੁੰਚਾ ਦਿੱਤਾ